ਸਰਕਾਰ ਨੇ ਨਾਗਰਿਕਾਂ ਲਈ ਬੈਂਕਿੰਗ ਨੂੰ ਸੌਖਾ ਬਣਾਉਣ ਲਈ ਬਹੁਤ ਸਾਰੀਆਂ ਯੋਜਨਾਵਾਂ ਚਲਾਈਆਂ ਹਨ ਜਿਵੇਂ ਕਿ ਬਹੁਤ ਸਾਰੀਆਂ ਡਿਜੀਟਲ ਯੋਜਨਾਵਾਂ ਸਾਰਾ ਕੰਮ ਕੰਪਿਊਟਰਸ 'ਤੇ ਹੋ ਜਾਂਦਾ ਲੋਕਾਂ ਨੂੰ ਬੈਂਕ ਵਿੱਚ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਨਾ ਹੀ ਉਹਨਾਂ ਨੂੰ ਲਾਈਨ ਵਿੱਚ ਖੜ੍ਹਨ ਦੀ ਜ਼ਰੂਰਤ ਪੈਂਦੀ ਉਹਨਾਂ ਦਾ ਟਾਈਮ ਵੀ ਬਚਦਾ ਆ ਅਤੇ ਉਹਨਾਂ ਦੀ ਹੈਲਥ ਵੀ ਇਸ ਤਰ੍ਹਾਂ ਕਿ ਕਈ ਕਈ ਬੰਦਾ ਕੋਈ ਨਹੀਂ ਸਹੀ ਹੁੰਦਾ ਕਿ ਉਹ ਬੈਂਕ 'ਚ ਜਾ ਸਕੇ ਤਾਂ ਫਿਰ ਉਹ ਘਰ ਬੈਠੇ ਹੀ ਆਪਣਾ ਸਾਰਾ ਕੰਮ ਕਰ ਸਕਦਾ ਆ ਅੱਗੇ ਅੱਗੇ ਹੋਰ ਵੀ ਨੈਟ ਬੈਂਕਿੰਗ ਵੀ ਘਰ ਬੈਠੇ ਹੀ ਸਾਰਾ ਆਪਣਾ ਅਕਾਊਂਟ ਓਪਨ ਕਰਵਾਉਣਾ ਅਤੇ ਆਪਾਂ ਘਰ ਬੈਠੇ ਕਰਵਾ ਸਕਦੇ ਹਾਂ ਸਾਨੂੰ ਬੈਂਕ 'ਚ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਹੋਰ ਵੀ ਬਹੁਤ ਸਾਰੀਆਂ ਜਿੱਦਾਂ ਕਿ ਪੈਨਸ਼ਨ ਹੋ ਗਈ ਜਿਹੜੀ ਪੈਨਸ਼ਨ ਹੈ ਉਹ ਆਪਣੇ ਆਪ ਹੀ ਬੈਂਕ ਦੇ ਵਿੱਚ ਆਉਂਦੀ ਹੈ ਅਤੇ ਫਿਰ ਬੰਦੇ ਨੂੰ ਆਪਣਾ ਆਪਣਾ ਖਰਚਾ ਹੈ ਜੋ ਉਹ ਚੱਕਣ 'ਚ ਕੋਈ ਤਕਲੀਫ ਨਹੀਂ ਹੁੰਦੀ ਹੈਗੀ ਉਹ ਖੁਦ ਹੀ ਆਪਣਾ ਖਰਚਾ ਚੱਕ ਸਕਦਾ ਆਪਣੇ ਪੈਸੇ ਕਢਵਾਉਂਦਾ ਅਤੇ ਆਪਣਾ ਖਰਚਾ ਖੁਦ ਕਰਦਾ ਖਾਣ ਪੀਣ ਦਾ ਜੋ ਵੀ ਕੁਛ ਲੈਣਾ ਸਭ ਫਿਰ ਹੋਰ ਵੀ ਬੈਂਕਿੰਗ ਦੇ ਬਹੁਤ ਸਾਰੇ ਸਹੂਲਤਾਂ ਜਿੱਦਾਂ ਕਿ ਯੂ ਪੀ ਆਈ ਕੋਡ ਬਹੁਤ ਸਾਰਾ ਚੱਲਿਆ ਗੂਗਲ ਪੇ ਹੋ ਗਿਆ ਪੇਟੀਐੱਮ ਹੋ ਗਿਆ ਬੰਦੇ ਨੂੰ ਕਿਤੇ ਵੀ ਜਾਣ ਲਈ ਆਪਣੇ ਕੋਲ ਕੇਸ਼ ਕੈਸ਼ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਉਹ ਕਿਤੇ ਵੀ ਜਾ ਰਿਹਾ ਕੋਈ ਸ਼ੋਪਿੰਗ ਕਰ ਰਿਹਾ ਜਾਂ ਫਿਰ ਕੁਛ ਵੀ ਖਰੀਦਣਾ ਤਾਂ ਉਹ ਪ ਗੂਗਲ ਪੇ ਜਾਂ ਫਿਰ ਪੇਟੀਐੱਮ ਦੀ ਵਰਤੋਂ ਕਰਕੇ ਆਸਾਨੀ ਨਾਲ ਮਤਲਬ ਕਰ ਸਕਦਾ ਉਹਨੂੰ ਜ਼ਰੂਰਤ ਨਹੀਂ ਪੈਂਦੀ ਕਿ ਉਹ ਪੈਸੇ ਨਾਲ਼ ਰੱਖੇ